ਸਾਡੇ ਖੇਤਰ ਵਿੱਚ ਕਈ ਰਵਾਇਤੀ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਕੋਟਲਾ ਛਪਾਕੀ ਹੋ ਗਈ ਖੋ ਖੋ ਖੇਡ ਹੋ ਗਈ ਕਬੱਡੀ ਖੇਡ ਹੋ ਗਈ ਕੁਸ਼ਤੀ ਖੇਡ ਹੋ ਗਈ ਅਤੇ ਇਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਖੇਡਾਂ ਨੇ ਜਿਸ ਤਰ੍ਹਾਂ ਕਬੱਡੀ ਕਬੱਡੀ ਵਿੱਚ ਚਾਰ ਸਟੋਪਰ ਹੁੰਦੇ ਨੇ ਚਾਰ ਰੋਕਣ ਵਾਲੇ ਖਿਡਾਰੀ ਹੁੰਦੇ ਨੇ ਅਤੇ ਇੱਕ ਕਬੱਡੀ ਪਾਉਣ ਜਾਂਦਾ ਹੈ ਜਦੋਂ ਇੱਕ ਕਬੱਡੀ ਪਾਉਣ ਜਾਂਦਾ ਹੈ ਤਾਂ ਚੌਹਾਂ ਵਿੱਚੋਂ ਉਹਨੂੰ ਇੱਕ ਨੂੰ ਕਿਸੇ ਨੇ ਰੋਕਣਾ ਹੁੰਦਾ ਹੈ ਜਿਹਨੇ ਕਿਸੇ ਇੱਕ ਖਿਡਾਰੀ ਨੇ ਉਸ ਸਟੋਪਰ ਨੂੰ ਰੋਕਣਾ ਹੁੰਦਾ ਵਾ ਜਿਸ ਤਰ੍ਹਾਂ ਉਸ ਤੋਂ ਬਾਅਦ ਸਾਡੀ ਖੇਡ ਆ ਗਈ ਕੁਸ਼ਤੀ ਕੁਸ਼ਤੀ ਵਿੱਚ ਦੋ ਭਲਵਾਨ ਆਪਣੇ ਜ਼ੋਰ ਵਿਖਾਉਂਦੇ ਨੇ ਜਿਸ ਤਰ੍ਹਾਂ ਦੋਵਾਂ ਭਲਵਾਨਾਂ ਨੇ ਅਖਾੜੇ ਵਿੱਚ ਘੁਲਣਾ ਹੁੰਦਾ ਹੈ ਇਹ ਖੇਡ ਜਿਹੜੀ ਹੈ ਮਿੱਟੀ ਵਿੱਚ ਹੁੰਦੀ ਹੈ ਜ਼ਿਆਦਾ ਅਤੇ ਹੁਣ ਜਿਸ ਤਰ੍ਹਾਂ ਸਮਾਂ ਬਦਲਣ ਦੇ ਨਾਲ ਨਾਲ ਇਹ ਇਹ ਖੇਡ ਜਿਹੜੀ ਆ ਗੱਦਿਆਂ 'ਤੇ ਵੀ ਹੋਣ ਲੱਗ ਪਈਆ ਮੈਟਾਂ ਵਾਲੀ ਕੁਸ਼ਤੀ ਵੀ ਇਹਨੂੰ ਕਿਹਾ ਜਾਂਦਾ ਕੋਟਲਾ ਛਪਾਕੀ ਹੋ ਗਈ ਖੋ ਖੋ ਇੱਕ ਬੈਠ ਕੇ ਖੇਡਣ ਵਾਲੀ ਗੇਮ ਆ ਬੈਠ ਕੇ ਖੇਡ ਕੇ ਜਿਹੜੀ ਖੋ ਖੋ ਆ ਇਹ ਬੈਠ ਕੇ ਖੇਡੀ ਜਾਂਦੀ ਹੈ